ਪੰਜਾਬੀ ਭਾਸ਼ਾ ਪੰਜਾਬ ਦੀ ਮਾਤ ਭਾਸ਼ਾ ਹੈ ਜੋ ਕਿ ਸਾਨੂੰ ਸਾਡੇ ਬਜ਼ੁਰਗਾਂ ਗੁਰੂਆਂ ਦੀ ਬਾਣੀ ਵਿੱਚੋਂ ਮਿਲੀ ਗਈ ਹੈ ਅਤੇ ਇਸ ਨੂੰ ਸੁਰੱਖਿਅਤ ਰੱਖਣਾ ਸਾਡਾ ਕਰਤੱਵ ਹੈ ਅਤੇ ਸਾਡਾ ਇਹ ਕਰਤੱਵ ਬਣਦਾ ਹੈ ਕਿ ਅਸੀਂ ਆਪਣੀ ਪੰਜਾਬੀ ਭਾਸ਼ਾ ਪੰਜਾਬੀ ਲਿਪੀ ਸਾਡੇ ਗੁਰੂਆਂ ਦੀ ਬਾਣੀ ਗੁਰੂਆਂ ਦੇ ਮੂੰਹੋਂ ਮੂੰਹਾਂ ਵਿੱਚੋਂ ਉਚਾਰੀ ਗਈ ਬਾਣੀ ਨੂੰ ਸੰਭਾਲ ਕੇ ਰੱਖੀਏ ਅਤੇ ਆਪਣੀ ਆਉਣ ਵਾਲੀ ਪੀੜੀ ਨੂੰ ਅੱਗੇ ਦੇ ਇਸ ਲਈ ਅੱਜ ਇਸ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਗਰਾਮ ਵਗੈਰਾ ਕਮ ਪ੍ਰੋਗਰਾਮ ਮੁਕਾਬਲੇ ਵਗੈਰਾ ਕਰਵਾਏ ਜਾ ਰਹੇ ਹਨ ਤਾਂ ਕਿ ਅਸੀਂ ਲੋਕਾਂ ਨੂੰ ਬੱਚਿਆਂ ਨੂੰ ਆਉਣ ਵਾਲੀ ਪੀੜੀ ਨੂੰ ਉਤਸ਼ਾਹਿਤ ਕਰ ਸਕੀਏ ਅਤੇ ਉਹਨਾਂ ਤੱਕ ਸੰਦੇਸ਼ ਪਹੁੰਚਾ ਸਕੀਏ ਕਿ ਸਾਡੀ ਪੰਜਾਬੀ ਬੋਲੀ ਸਾਡੇ ਜੀਵਨ ਦੇ ਵਿੱਚ ਕੀ ਮਹੱਤਵ ਰੱਖਦੀ ਹੈ ਅਤੇ ਇਹਨਾਂ ਨੂੰ ਉਤਸ਼ਾਹਿਤ ਕਰਨ ਲਈ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਅਤੇ ਹੋਰ ਜ਼ਿਲ੍ਹੇ ਪੱਧਰ ਦੇ ਉੱਤੇ ਕਾਫੀ ਪ੍ਰੋਗਰਾਮ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਹਦੇ ਵਿੱਚ ਬੱਚੇ ਬਜ਼ੁਰਗ ਅਧਿਆਪਕ ਅਤੇ ਪੰ ਛੋਟੇ ਬੱਚੇ ਵੱਡੇ ਬੱਚੇ ਕਾਫੀ ਹਿੱਸਾ ਲੈਂਦੇ ਹਨ ਅਤੇ ਉਹ ਆਪਣੇ ਇਸ ਹਿੱਸਾ ਇਸ ਕਰਕੇ ਲੈਂਦੇ ਹਨ ਕਿ ਤਾਂ ਕਿ ਅਸੀਂ ਆਪਣਾ ਨਾਮ ਰੌਸ਼ਨ ਕਰ ਸਕੀਏ ਅਤੇ ਕੁਝ ਇੱਦਾਂ ਦਾ ਅਲੱਗ ਕਰੀਏ ਬਾਕੀਆਂ ਨਾਲੋਂ ਜੋ ਕਿ ਸਾਨੂੰ ਬਾਕੀਆਂ ਨਾਲੋਂ ਅਲੱਗ ਦਿਖਾਉਣ ਇਸ ਲਈ ਜਿਹੜੇ ਜ਼ਿਲ੍ਹਾ ਪੱਧਰ ਦੇ ਲੋਕ ਹੁੰਦੇ ਆ ਜਿਵੇਂ ਡੀ ਸੀ ਹੋ ਗਏ ਜਾਂ ਸਕੂਲ ਦੇ ਪ੍ਰਿੰਸੀਪਲ ਹੋ ਗਏ ਸਮੂਹ ਪੱਧਰ 'ਤੇ ਜਿਹੜੇ ਉੱਚ ਪਦਵੀਆਂ ਦੇ ਲੋਕ ਹੁੰਦੇ ਹਨ ਉਹ ਕਵਿਤਾ ਦਾ ਮੁਕਾਬਲਾ ਪੋਸਚਰ ਮੇਕਿੰਗ ਦਾ ਮੁਕਾਬਲਾ ਭਾਸ਼ਣ ਮੁਕਾਬਲਾ ਰੈਲੀਆਂ ਵਗੈਰਾ ਨਾਟਕ ਵਗੈਰਾ ਆਦਿ ਕਰਵਾਉਂਦੇ ਹਨ ਅਤੇ ਇਹਨਾਂ ਵਿੱਚ ਬੱਚਿਆਂ ਨੂੰ ਟੀਚਰਾਂ ਵੱਲੋਂ ਕਾਫੀ ਜ਼ਿਆਦਾ ਕੰਮ ਦਿੱਤਾ ਜਾਂਦਾ ਹੈ ਕਿ ਤਾਂ ਕਿ ਉਹ ਆਪਣੀ ਪੂਰੀ ਮਿਹਨਤ ਨਾਲ ਲੱਗ ਕੇ ਇਸ ਕੰਮ ਨੂੰ ਪੂਰਾ ਕਰ ਸਕਣ ਅਤੇ ਇਹਨਾਂ ਵਿੱਚ ਜਦੋਂ ਬੱਚੇ ਆਪਣੇ ਵਿਚਾਰ ਦੂਜਿਆਂ ਸਾਹਮਣੇ ਪੇਸ਼ ਕਰਦੇ ਹਨ ਜਾਂ ਆਪਣੇ ਵੱਲੋਂ ਵਿਚਾਰਾਂ ਨੂੰ ਲਿਖਦੇ ਹਨ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਉਜਾਗਰ ਹੁੰਦੀ ਹੈ ਕਿ ਸਾਡੀ ਪੰਜਾਬੀ ਬੋਲੀ ਸਾਡੇ ਜੀਵਨ ਦੇ ਵਿੱਚ ਅਤੇ ਸਾਡੇ ਪਰਿਵਾਰ ਬਾਕੀ ਲੋਕਾਂ ਦੇ ਜੀਵਨ ਦੇ ਵਿੱਚ ਕੀ ਮਹੱਤਵ ਰੱਖਦੀ ਹੈ ਅਤੇ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਦੇ ਵਿਚਾਰਾਂ ਨੂੰ ਸੁਣ ਕੇ ਬਾਕੀ ਲੋਕ ਵੀ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਪ੍ਰਭਾਵਿਤ ਹੋ ਕੇ ਆਪਣੀ ਮਾਤ ਬੋਲੀ ਪੰਜਾਬੀ ਬੋਲੀ ਨੂੰ ਸੁਰੱਖਿਅਤ ਰੱਖਦੇ ਹਨ ਅਤੇ ਹਰੇਕ ਇਲਾਕੇ ਦੀ ਆਪਣੀ ਅਲੱਗ ਅਲੱਗ ਬੋਲੀ ਹੁੰਦੀ ਹੈ ਜਿਵੇਂ ਕਿ ਪੁਆਧੀ ਦੁਆਬੀ ਪੋਠਹਾਰੀ ਮਲਵਈ ਅਤੇ ਹਰੇਕ ਇਲਾਕੇ ਦੀ ਆਪਣੀ ਆਪਣੀ ਬੁ ਉਪ ਬੋਲੀ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਮਹੱਤਵ ਰੱਖਦੀ ਹੈ ਜੋ ਕਿ ਸਾਨੂੰ ਆਪਸ ਦੇ ਵਿੱਚ ਜੋੜੀ ਰੱਖਦੀ ਹੈ ਇਸ ਲਈ ਇਹ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਕਿ ਅਸੀਂ ਆਪਣੀ ਪੰਜਾਬੀ ਬੋਲੀ ਨੂੰ ਸੁਰੱਖਿਅਤ ਰੱਖ ਸਕੀ ਰੱਖ ਰੱਖ ਸਕੀਏ ਅਤੇ ਬਾਕੀ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾ ਸਕੀਏ